ਜੇਕਰ ਖੇਡਾਂ ਨਾਲ ਸਬੰਧਿਤ ਕੋਈ ਵੀ ਹਿੰਸਾ ਦਾ ਮੁੱਦਾ ਹੈ ਤਾਂ ਉਸੇ ਵੇਲੇ ਰੈਫ਼ਰੀ ਤੇ ਇਹਨੂੰ ਮਸਲੇ ਨੂੰ ਹੱਲ ਕਰ ਸਕਦਾ ਹੈ ਅਗਰ ਰੈਫ਼ਰੀ ਦਾ ਮਸਲਾ ਹੱਲ ਕਰਨ 'ਚ ਕੋਈ ਯੋਗਦਾਨ ਨਹੀਂ ਹੁੰਦਾ ਤਾਂ ਉਸ ਪਿੰਡ ਦੇ ਵਿੱਚ ਖੇਡਾਂ ਸਬੰਧਿਤ ਕਮੇਟੀ ਬਣਾਈ ਜਾਂਦੀ ਹੈ ਉਹ ਕਮੇਟੀ ਉਸ ਮੁੱਦੇ ਨੂੰ ਵਿਚਾਰਦੀ ਹੈ ਜੋ ਕਿ ਬਹੁਤ ਹੀ ਵਧੀਆ ਢੰਗ ਹੈ ਅਗਰ ਉਸ ਵੇਲੇ ਵੀ ਹਿੰਸਾ ਦਾ ਮੁੱਦਾ ਸੋਲਵ ਨਹੀਂ ਹੁੰਦਾ ਜਾਂ ਹੱਲ ਨਹੀਂ ਹੁੰਦਾ ਤਾਂ ਪਿੰਡ ਦੀ ਪੰਚਾਇਤ ਉਸ ਮੁੱਦੇ ਨੂੰ ਆਪਣੇ ਅਧਿਕਾਰ ਖੇਤਰ 'ਚ ਲੈ ਲੈਂਦੀ ਹੈ ਅਤੇ ਉਹ ਬੜੇ ਠਰੱਮੇ ਦੇ ਨਾਲ ਇਸ ਖੇਡ ਦੇ ਪ੍ਰਤੀ ਸੁਝਾਅ ਦਿੰਦੀ ਹੈ ਅਗਰ ਫਿਰ ਵੀ ਦੋਨੋ ਧਿਰਾਂ ਨਾ ਸਹਿਮਤ ਹੋਣ ਤਾਂ ਅਗਲੇਰੀ ਕਾਰਵਾਈ ਜੋ ਕਿ ਪੁਲਿਸ ਵਿੱਚ ਹੈ ਐਫ ਆਈ ਆਰ ਲਿਖਾ ਦਿੰਦੇ ਹਨ ਉਹ ਕਰਨੀ ਪੈਦੀ ਹੈ ਜਿਸਦੇ ਨਾਲ ਕਿ ਮਸਲਾ ਹੱਲ ਹੋ ਜਾਵੇ